ਹਾਂਜੀ ਹਾਂਜੀ ਸਾਡੇ ਕੋਲ ਸਾਡੇ ਕੋਲ ਬਹੁਤ ਸਾਰੀਆਂ ਐਟਮਾਂ ਹੁੰਦੀਆਂ ਨੇ ਜੀ ਜਿਹਦੇ 'ਚ ਸਾਡਾ ਸਭ ਤੋਂ ਮਸ਼ਹੂਰ ਤਾਂ ਹੈਗਾ ਜੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਨਾਲ ਮੱਖਣ ਨਾਲ ਲੱਸੀ ਹਾਂਜੀ ਅਤੇ ਹੋਰ ਸਾਡੇ ਕੋਲ ਰਾਜਮਾਂਹ ਚਾਵਲ ਵੀ ਹੁੰਦੇ ਨੇ ਜੀ ਸਾਡੇ ਕੋਲ ਕੜੀ ਚਾਵਲ ਵੀ ਹੁੰਦੇ ਨੇ ਜੀ ਹਾਂਜੀ ਸਾਡੇ ਕੋਲ ਤੰਦੂਰੀ ਨਾਨ ਵੀ ਹੁੰਦੇ ਨੇ ਸਿੰਪਲ ਨਾਨ ਵੀ ਹੁੰਦੇ ਨੇ ਜੀ ਹਾਂਜੀ ਆ ਜਾਓ ਜੀ ਆ ਜਾਓ ਮੋਸਟ ਵੈਲਕਮ ਹਾਂਜੀ ਅਤੇ ਹੋਰ ਸਾਡੇ ਕੋਲ ਜੀ ਜਿਵੇਂ ਮਤਲਬ ਕੇ ਹੁੰਦਾ ਵੀ ਸ਼ਾਹੀ ਪਨੀਰ ਹੁੰਦਾ ਜੀ ਕੜਹੀ ਪਨੀਰ ਹੁੰਦਾ ਹੈ ਗਾ ਨੋਨ ਵੈੱਜ ਵੀ ਹੁੰਦਾ ਸਾਡੇ ਕੋਲ ਬਟਰ ਚਿਕਨ ਵੀ ਹੁੰਦਾ ਜੀ ਸਾਡੇ ਕੋਲ ਤੰਦੂਰੀ ਚਿਕਨ ਵੀ ਹੁੰਦਾ ਜੀ ਹਾਂਜੀ ਹਾਂਜੀ ਹਾਂਜੀ ਹੋਰ ਹੋਰ ਵੀ ਬਹੁਤ ਸਾਰੀਆਂ ਸਾਡੇ ਕੋਲ ਚੀਜਾਂ ਹੁੰਦੀਆਂ ਨੇ ਜੀ ਅਸੀਂ ਸਭ ਹੀ ਰੱਖਦੇ ਹਾਂ ਜੀ ਆਪਣਾ ਮਤਲਬ ਕੇ ਜਿਵੇਂ ਕੁਲਚੇ ਛੋਲੇ ਹੋ ਗਏ ਛੋਲੇ ਭਠੂਰੇ ਹੋ ਗਏ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਸਾਡੇ ਕੋਲ ਮਿਕਸ ਵੈੱਜ ਵੀ ਬਹੁਤ ਵਧੀਆ ਹੁੰਦੀਆਂ ਆ ਸਾਡੇ ਕੋਲ ਆਲੂ ਵਾਲੇ ਪਰੋਂਠੇ ਵੀ ਹੁੰਦੇ ਨੇ ਗੇ ਨਾਸ਼ਤੇ ਦੇ ਵਿੱਚ ਗੋਭੀ ਵਾਲੇ ਵੀ ਹੁੰਦੇ ਨੇ ਗੇ ਹਾਂਜੀ ਹਾਂਜੀ ਹਾਂਜੀ ਆਓ ਜੀ ਜ਼ਰੂਰ ਜੀ ਹਾਂਜੀ ਸਾਡਾ ਅਸੀਂ ਸਾਰੀਆਂ ਚੀਜ਼ਾਂ ਸਾਡੇ ਕੋਲ ਚਾਹ ਵ ਚਾਹ ਵੀ ਅਸੀਂ ਬਹੁਤ ਵਧੀਆ ਬਣਾਉਣੇ ਹਾਂ ਜੀ ਗੁੜ ਵਾਲੀ ਚਾਹ ਬਣਾਉਣੇ ਹਾਂ ਜੀ ਅਤੇ ਗੁੜ ਵੀ ਸਾਡਾ ਆਪਣਾ ਹੀ ਹੁੰਦਾ ਜੀ ਬਣਾਇਆ ਹੋਇਆ

ਹਾਂਜੀ ਹਾਂ ਨਹੀਂ ਨਹੀਂ ਘਰ ਦਾ ਹੁੰਦਾ ਜੀ ਅਸੀਂ ਆਪਣਾ ਆਪ ਤਿਆਰ ਕਰਦੇ ਹਾਂ ਆਪਣੀਆਂ ਮੱਝਾਂ ਦੁੱਧ ਦੁੱਧ ਲਿਆਉਂਦੇ ਹਾਂ ਜੀ ਚੋਅ ਕੇ ਹਾਂਜੀ ਹਾਂਜੀ ਮਿਲਾਵਟ ਵਾਲੀ ਕੋਈ ਚੀਜ਼ ਨਹੀ ਜੀ ਅਸੀਂ ਵਰਤਦੇ ਅਸੀਂ ਆਪਣੇ ਮਸਾਲੇ ਵੀ ਆਪ ਹੀ ਤਿਆਰ ਕਰਦੇ ਹਾਂ ਸਾਰੇ ਹਾਂਜੀ ਹਾਂਜੀ ਹਾਂਜੀ ਹਾਂ ਜੀ ਹਾਂ ਸਾਫ਼ ਸੁਥਰਾ ਰੱਖਦੇ ਹਾਂ ਸਾਰਾ ਐਨ ਵਧੀਆ ਕੋਈ ਇਹ ਜਿਹੀ ਗੱਲ ਨਹੀ ਹੈਗੀ ਤੁਸੀਂ ਆਉਗੇ ਜਦੋਂ ਤੁਹਾਨੂੰ ਸਾਰਾ ਸਾਡਾ ਖਾਣਾ ਬਹੁਤ ਵਧੀਆ ਪਸੰਦ ਆਊ ਅਸੀਂ ਬਹੁਤ ਵਧੀਆ ਸਰਵ ਕਰਦੇ ਹਾਂ ਜੀ ਸਾਰਾ ਕੁਛ ਵਧੀਆ ਕਰਦੇ ਹਾਂ ਜੀ ਸਾਫ਼ ਸੁਥਰਾ ਰੱਖਦੇ ਹਾਂ ਹਾਂਜੀ ਹਾਂਜੀ ਹਾਂ ਸਫ਼ਾਈ ਪੂਰੀ ਰੱਖਦੇ ਹਾਂ ਜੀ ਹਾਂਜੀ ਹਾਂਜੀ ਆਉ ਆਉ ਜੀ ਜ਼ਰੂਰ ਜੀ ਹੂੰ ਠੀਕ ਹੈ ਜੀ